ਮਾਨਸਿਕ ਸਿਹਤ ਸਮੱਸਿਆ ਇੱਕ ਅਜਿਹੀ ਚੀਜ਼ ਹੈ ਜਿਸਦੇ ਨਾਲ ਮਨੁੱਖ ਦੀ ਸਾਰੀ ਮਨੋਦਸ਼ਾ ਖਰਾਬ ਹੋ ਜਾਂਦੀ ਹੈ ਮਾਨਸਿਕ ਸਿਹਤ ਸਮੱਸਿਆ ਵਿੱਚ ਉਦਾਸੀ ਚਿੰਤਾ ਇਹ ਦੋਨੋਂ ਚੀਜ਼ਾਂ ਆਉਂਦੀਆਂ ਹਨ ਜੇਕਰ ਇਸ ਹੋਊਗੀਆਂ ਤਾਂ ਇਸਦੇ ਨਾਲ ਮਨੁੱਖ ਦੀ ਮਨੁੱਖ ਦੀ ਲਾਈਫ ਵਿੱਚ ਬਹੁਤ ਸਾਰੀਆਂ ਪ੍ਰੋਬਲਮਸ ਹੋਣਗੀਆਂ ਉਦਾਸੀ ਪ ਪਹਿਲਾਂ ਉਸਨੂੰ ਥੋੜ੍ਹੇ ਟਾਈਮ ਲਈ ਉਸੀ ਚੀਜ਼ ਨੂੰ ਲੈ ਕੇ ਉਦਾਸੀ ਹੁੰਦੀ ਹੈ ਫਿਰ ਉਸਨੂੰ ਡੂੰਘਾਈ 'ਚ ਉਸਦੇ ਬਾਰੇ ਸੋਚਦਾ ਜਾਂਦਾ ਸੋਚਦਾ ਜਾਂਦਾ ਹੈ ਤਾਂ ਉਹ ਇੱਕ ਵੱਡੀ ਬਿਮਾਰੀ ਦਾ ਰੂਪ ਧਾਰਨ ਕਰ ਲੈਂਦੀ ਹੈ ਪਰ ਜਦੋਂ ਇਸ ਚੀਜ਼ ਘਰਦਿਆਂ ਨੂੰ ਪਤਾ ਲੱਗਦੀ ਹੈ ਤਾਂ ਉਹ ਇਸ ਚੀਜ਼ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦੇ ਆ ਪਰ ਇਹ ਬਿਲਕੁਲ ਗਲਤ ਹੈ ਜੇਕਰ ਉਹ ਲੁਕਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਉਹ ਉਹਨਾਂ ਦਾ ਆਪਣਾ ਹੀ ਬਹੁਤ ਵੱਡਾ ਘਾਟਾ ਹੈ ਜੇ ਜੇਕਰ ਉਹ ਇਸਦਾ ਇਸਨੂੰ ਸਾਰਿਆਂ ਨੂੰ ਦੱਸਣ ਇਸਦਾ ਇਲਾਜ ਕਰਾਣ ਤਾਂ ਉਹ ਆਪਣੇ ਘਰ ਦੀ ਮੈਂਬਰ ਨੂੰ ਠੀਕ ਕਰ ਸਕਦੇ ਹੈ ਪਰ ਜਿੱਦਾਂ ਨਹੀਂ ਕਰੋਗੇ ਤਾਂ ਉਹ ਇਸਨੂੰ ਗਵਾ ਦੇਣਗੇ ਜਿਸ ਕਰਕੇ ਬਹੁਤ ਸਾਰੀਆਂ ਉਹਨਾਂ ਨੂੰ ਸਮੱਸਿਆਵਾਂ ਆਉਣਗੀਆਂ ਅਤੇ ਇਸਦੇ ਲਈ ਉਹਨਾਂ ਨੂੰ ਇਸਦੇ ਬਾਰੇ ਵਿੱਚ ਸਭ ਨੂੰ ਮਤਲਬ ਇੱਕ ਕਿਸੇ ਸੰਸਥਾ ਵਿੱਚ ਜਾ ਕੇ ਦੱਸਣਾ ਚਾਹੀਦਾ ਹੈ ਅਤੇ ਇਹ ਸੰਸਥਾ ਅੰਮ੍ਰਿਤਸਰ ਵਿੱਚ ਵੀ ਇੱਕ ਹੈ ਜਿੱਥੋਂ ਜਾ ਕੇ ਉਹ ਆਪਣੀ ਮਦਦ ਕਰਵਾ ਸਕਦੇ ਹਨ ਜਿਸ ਦੇ ਨਾਲ ਉਹ ਉਹਨਾਂ ਨੂੰ ਬਹੁਤ ਜ਼ਿਆਦਾ ਮਦਦ ਮਿਲ ਸਕਦੀ ਹੈ